ਮੈਂ ਯਾਤਰਾ ਵਿੱਚ ਹੇਮਕੁੰਟ ਸਾਹਿਬ ਦੇ ਵਿੱਚ ਜਾਣਾ ਚਾਹੁੰਦਾ ਹਾਂ ਵੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਜਾ ਕੇ ਕਿਸ ਤ ਤਰੀਕੇ ਨਾਲ ਭਗਤੀ ਕੀਤੀ ਸੀ ਅਤੇ ਕਿਸ ਤਰੀਕੇ ਦਾ ਗੁਰਦੁਆਰਾ ਸਾਹਿਬ ਆ ਮੈਂ ਦੇਖਣਾ ਜ ਚਾਹੁੰਦਾ ਅਤੇ ਮੇਰੇ ਦਿਲ ਦਾ ਅਰਮਾਨ ਆ ਮ ਮੇਰਾ ਉੱਥੇ ਜਾਣ ਦਾ ਇੱਕ ਟਾਸਕ ਆ ਜਾਣਾ ਜ਼ਰੂਰ ਆ